ਚੌਦਾਂ ਜਨਵਰੀ ਦੋ ਹਜ਼ਾਰ ਦੋ ਇੱਕ ਜੂਨ ਦੋ ਹਜ਼ਾਰ ਚਾਰ ਦੋ ਮਾਰਚ ਉੱਨੀ ਸੌ ਬਹੱਤਰ ਤੇਰ੍ਹਾਂ ਨਵੰਬਰ ਉੱਨੀ ਸੌ ਪੰਝੱਤਰ ਵੀਹ ਜੁਲਾਈ ਦੋ ਹਜ਼ਾਰ ਪੰਜ